ਮੈਂ ਬੁਣਾਈ ਅਤੇ ਸਿਲਾਈ ਅੱਠਵੀਂ ਜਮਾਤ ਵਿੱਚ ਸ਼ੁਰੂ ਕੀਤੀ ਜਦੋਂ ਮੈਂ ਅੱਠਵੀਂ 'ਚ ਪੜ੍ਹਦੀ ਸੀ ਉਦੋਂ ਸਾਡਾ ਸਕੂਲ ਇੱਕ ਸਿਲਾਈ ਦਾ ਪੀਰੀਅਡ ਲੱਗਦਾ ਹੁੰਦਾ ਉੱਥੇ ਸਾਨੂੰ ਸਾਡੇ ਸਿਲਾਈ ਵਾਲੇ ਮੈਡਮ ਸਿਖਾਉਂਦੇ ਹੁੰਦੇ ਸੀ ਘੂਰੇ ਕਿੱਤਰਾਂ ਪਾਉਣੇ ਨੇ ਸਿਲਾਈ ਦੇ ਅਤੇ ਤਰਪਾਈ ਕਿੱਦਾਂ ਕਰਨੀ ਆ ਉੱਥੇ ਸਾਡੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਰੁਮਾਲਾਂ 'ਤੇ ਕਢਾਈ ਕਰਵਾਈ ਜਾਂਦੀ ਸੀ ਜਿਵੇਂ ਕੱਚਾ ਟਾਂਕਾ ਤਰਪਾਈ ਮੱਛੀ ਟਾਂਕਾ ਸਿੰਧੀ ਤੋਪਾ ਅਤੇ ਉਹ ਰੁਮਾਲ ਅਲੱਗ ਅਲੱਗ ਤਰ੍ਹਾਂ ਦੇ ਕੱਢਣੇ ਫੁੱਲ ਟਾਂਕਾ ਜੰਜੀਰ ਟਾਂਕਾ ਇਹ ਸਾਰੇ ਸਾਨੂੰ ਸਾਡੇ ਸਕੂਲ ਵਾਲੇ ਸਿਲਾਈ ਵਾਲੇ ਮੈਡਮ ਨੇ ਸਿਖਾਇਆ ਸੀ ਉਹਨਾਂ ਨੇ ਸਿਲਾਈ ਵਿੱਚ ਵੀ ਬੁਣਾਈ ਵਿੱਚ ਵੀ ਉਹਨਾਂ ਨੇ ਸਾਨੂੰ ਭੂਰੇ ਪਾਉਣੇ ਅਤੇ ਛੋਟੇ ਬੱਚੇ ਦੀਆਂ ਜੁਰਾਬਾਂ ਬਣਾਉਣੀਆਂ ਵੀ ਪਹਿਲਾਂ ਸਿੱਧਾ ਸਿੱਧਾ ਉਣਨਾ ਆ ਫਿਰ ਉਹਦੇ ਤਿੰਨ ਹਿੱਸੇ ਕਰਨੇ ਆ ਫਿਰ ਵਿਚਲੇ ਹਿੱਸੇ ਨੂੰ ਥੋੜ੍ਹਾ ਜ਼ਿਆਦਾ ਉਣਨਾ ਆ ਅਤੇ ਉਸ ਤੋਂ ਬਾਅਦ ਜਿਹੜਾ ਆ ਉਹ ਤਿੰਨਾਂ ਹਿੱਸਿਆਂ ਨੂੰ ਫਿਰ ਇੱਕ ਕਰ ਲੈਣਾ ਅਤੇ ਫਿਰ ਉਹਨਾਂ ਨੂੰ ਜੋੜ ਕੇ ਜਰਾਬਾ ਬਣ ਜਾਣੀਆਂ ਫਿਰ ਟੋਪੀ ਬਣਾਉਣੀ ਸਿਖਾਈ ਟੋਪੀ ਜਿਹੜੀ ਓਹ ਪੀ ਇੱਕ ਘੁਰੇ ਤੋਂ ਸ਼ੁਰੂ ਕਰਨੀ ਫਿਰ ਹੌਲੀ ਹੌਲੀ ਉਹਨੂੰ ਵਧਾਉਂਦੇ ਜਾਣਾ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਸਾਡੇ ਸਕੂਲ ਦੇ ਸਿਲਾਈ ਵਾਲੇ ਮੈਡਮ ਨੇ ਸਾਨੂੰ ਸਿਖਾਏ ਸੀ ਅਤੇ ਹੁਣ ਅੱਜ ਕੱਲ੍ਹ ਇਹਨਾਂ ਚੀਜ਼ਾਂ ਦਾ ਰੁਝਾਨ ਸਕੂਲਾਂ ਵਿੱਚੋਂ ਬਹੁਤ ਘੱਟ ਗਿਆ ਪਰ ਮੈਂ ਚਾਹੁੰਦੀ ਹਾਂ ਸਕੂਲਾਂ ਵਿੱਚ ਇਹੋ ਜਿਹੇ ਵਿਸ਼ੇ ਵੀ ਹੋਣੇ ਚਾਹੀਦੇ ਹਨ ਅਤੇ ਸਿਲਾਈ ਅਤੇ ਸਿਲਾਈ ਦੇ ਵਿੱਚ ਕ ਛੋਟੇ ਛੋਟੇ ਰੁਮਾਲ ਬਣਾਉਣੇ ਤਾਂ ਸਕੂਲ ਸਿੱਖੇ ਸੀ ਉਸ ਤੋਂ ਬਾਅਦ ਆ ਜਦੋਂ ਸਾਨੂੰ ਫਸਟ ਈਅਰ ਕੋਲੇਜ ਦੇ ਵਿੱਚ ਸਾਨੂੰ ਓਦੋਂ ਦੋ ਦੋ ਤਿੰਨ ਤਿੰਨ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਕਿਉਂਕਿ ਰਿਜ਼ਲਟ ਜਿਹੜਾ ਉਹ ਕਾਫੀ ਲੇਟ ਆਉਂਦਾ ਹੁੰਦਾ ਸੀ ਉਦੋਂ ਕੰਪਿਊਟਰਾਂ 'ਤੇ ਰਿਜ਼ਲਟ ਨਹੀਂ ਸੀ ਬਣਦਾ ਅਤੇ ਕਾਫੀ ਲੇਟ ਰਿਜਲਟ ਆਉਂਦਾ ਹੁੰਦਾ ਸੀ ਸਾਨੂੰ ਤਿੰਨ ਤਿੰਨ ਮਹੀਨੇ ਦੀਆਂ ਛੁੱਟੀਆਂ ਹੋਣੀਆਂ ਫਿਰ ਸਾਡੇ ਨਾ ਇੱਕ ਮੇਰੀ ਸਹੇਲੀ ਦੇ ਮਾਤਾ ਜੀ ਸੀ ਉਹਨਾਂ ਨੇ ਸਾਨੂੰ ਡਾਂਟਿਆ ਵੀ ਤੁਸੀਂ ਵਿਹਲੀਆਂ ਕੀ ਕਰਦੀਆਂ ਰਹਿੰਦੀਆਂ ਜੇ ਅਤੇ ਉਹ ਸਾਨੂੰ ਇੱਕ ਸਿਲਾਈ ਸੈਂਟਰ 'ਤੇ ਛੱਡ ਆਏ ਅਤੇ ਫਿਰ ਉਹਨਾਂ ਨੇ ਸਾਨੂੰ ਮਹੀਨਾ ਦੋ ਮਹੀਨੇ ਉੱਥੇ ਅਸੀਂ ਸਲਾਈ ਸਿੱਖੀ ਉੱਥੇ ਵੀ ਉਹਨਾਂ ਨੇ ਸਾਨੂੰ ਸੂਟ ਸੀਨੇ ਸਿਖਾਏ ਉਦੋਂ ਕਲੀਆਂ ਵਾਲੇ ਸੂਟਾਂ ਦਾ ਰਿਵਾਜ਼ ਸੀ ਦੋ ਕਲੀਆਂ ਵਾਲੇ ਸੌਲ੍ਹਾਂ ਕਲੀਆਂ ਵਾਲੇ ਅਤੇ ਇਸ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੇ ਸੂਟ ਉਹਨਾਂ ਨੇ ਸਾਨੂੰ ਸਿਖਾਏ ਉਹ ਦੀਦੀ ਵੀ ਬਹੁਤ ਚੰਗੇ ਸੀ ਉਹਨਾਂ ਦੀ ਬੁਟੀਕ ਅਜੇ ਵੀ ਬਹੁਤ ਚੱਲਦੀ ਹੈ ਇਸ ਤਰ੍ਹਾਂ ਮੈਨੂੰ ਜਿਹੜਾ ਆ ਉਹ ਦਿਲਚਸਪੀ ਹੌਲੀ ਹੌਲੀ ਮੇਰੀ ਵੱਧਦੀ ਗਈ ਉਸ ਤੋਂ ਬਾਅਦ ਮੈਂ ਸਿਲਾਈ ਕਰਨੀ ਛੱਡ ਦਿੱਤੀ ਕਿਉਂਕਿ ਮੇਰੀ ਛੋਟੀ ਸਿਸਟਰ ਬਹੁਤ ਵਧੀਆ ਸਿਲਾਈ ਕਰ ਲੈਂਦੀ ਸੀ ਅਤੇ ਫਿਰ ਮੈਂ ਕਿਹਾ ਵੀ ਚਲੋ ਹੁਣ ਉਹਦੇ ਕੋਲ ਹੀ ਕਰਾਈ ਜਾਓ ਆਪ ਮੈਂ ਛੱਡ ਹੀ ਦਿੱਤੀ ਸੀ ਫਿਰ ਉਹਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਮੈਨੂੰ ਫਿਰ ਲੱਗਾ ਵੀ ਸੂਟ ਦੀ ਸਵਾਈ ਬਾਹਰ ਦੇਣੀ ਇੱਕ ਵੇਸਟ ਓਫ ਮਨੀ ਹੈ ਅਤੇ ਇਸ ਕਰਕੇ ਮੈਨੂੰ ਇਹ ਫਿਰ ਤੋਂ ਜਿਹੜਾ ਵਾ ਸ਼ੁਰੂ ਕਰ ਲੈਣਾ ਚਾਹੀਦਾ ਹੁਣ ਵੀ ਮੈਂ ਸੂਟ ਸੀਂਦੀ ਕਰਦੀ ਰਹਿੰਦੀ ਹਾਂ ਕੋਸ਼ਿਸ਼ ਪਰ ਟਾਈਮ ਬੜਾ ਲੱਗ ਜਾਂਦਾ ਹੈ